ਹੈਲੋ ਸਤਿ ਸ਼੍ਰੀ ਅਕਾਲ ਜੀ ਕੀ ਤੁਸੀਂ ਭਗਤ ਜੀ ਰੈਸਟੋਰੈਂਟ ਤੋਂ ਬੋਲ ਰਹੇ ਹੋ ਐਕਚੁਲੀ ਸਰ ਮੈਂ ਕੁਛ ਟਾਈਮ ਹੀ ਪਹਿਲਾਂ ਪੰਜ ਛੇ ਖਾਣ ਵਾਲੀਆਂ ਆਈਟਮਾਂ ਦਾ ਔਡਰ ਦਿੱਤਾ ਸੀ ਜਿਹਦੇ ਵਿੱਚ ਦਾਲ ਮਲਾਈ ਪਨੀਰ ਚਪਾਤੀ ਮਿੱਠਾ ਪਾਓ ਭਾਜੀ ਅਤੇ ਡੋਸਾ ਸੀ ਇਹ ਪੂਰਾ ਔਡਰ ਕਰੀਬ ਪੱਚੀ ਸੌ ਰੁਪਏ ਦਾ ਸੀ ਕਿਸੇ ਕਾਰਨ ਵੱਸ ਕਰਕੇ ਮੈਨੂੰ ਅਚਾਨਕ ਦਫਤਰੀ ਕੰਮ ਦੇ ਲਈ ਹੁਣੇ ਘਰੋਂ ਬਾਹਰ ਨਿਕਲਣਾ ਪੈ ਗਿਆ ਅਤੇ ਮੈਂ ਔਡਰ ਰਿਸੀਵ ਕਰਨ ਨਹੀਂ ਸ ਜਾ ਸਕੀ ਕਿਰਪਾ ਕਰਕੇ ਮੇਰਾ ਇਹ ਔਡਰ ਕੈਂਸਲ ਕਰ ਦਿੱਤਾ ਜਾਵੇ ਔਰ ਜੋ ਮੈਂ ਪੇਮੈਂਟ ਕਰ ਦਿੱਤੀ ਹੈ ਉਸ ਮੈਨੂੰ ਪੇਮੈਂਟ ਨੂੰ ਕੈਸ਼ ਪੇਮੈਂਟ ਵਾਪਸ ਕਰ ਦਿੱਤੀ ਜਾ ਸਕਦੀ ਹੈ ਅਗਰ ਤੁਸੀਂ ਇਹ ਪੈਸੇ ਵਾਪਸ ਕਰ ਸਕਦੇ ਹੋ ਤਾਂ ਮੈਂ ਤੁਹਾਡੀ ਬਹੁਤ ਬਹੁਤ ਧੰਨਵਾਦੀ ਹੋਵਾਂਗੀ